ਮੈਂ ਅੱਜ ਕੱਲ੍ਹ ਉਮਰ ਦੇ ਲਿਹਾਜ਼ ਦੇ ਨਾਲ ਮੇਰੀ ਉਮਰ ਇਸ ਵੇਲੇ ਬਾਹਠ ਸਾਲ ਦੀ ਹੈ ਮੈਂ ਦੌੜਨ ਦੇ ਨਾਲੋਂ ਸੈਰ ਕਰਨੀ ਲੌਗ ਲੰਬੀ ਸੈਰ ਕਰਨੀ ਜ਼ਿਆਦਾ ਠੀਕ ਸਮਝਦਾ ਹਾਂ ਇਸ ਦੇ ਨਾਲ ਅਲੱਗ ਅਲੱਗ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਸੰਤੁਸ਼ਟੀ ਪ੍ਰਾਪਤ ਹੋਈ ਹੈ ਜਿਵੇਂ ਕਿ ਮੈਨੂੰ ਪਹਿਲਾਂ ਕੁਛ ਮੋਟਾਪਾ ਸੀ ਅਤੇ ਸਿਹਤ ਦੇ ਕਾਫੀ ਮੋਟਾਪੇ ਨਾਲ ਬਦਰੂਪ ਸੀ ਦਿਖਦੀ ਸੀ ਅਤੇ ਉਸ ਤੋਂ ਬਾਅਦ ਸਾਹ ਫੁੱਲਦਾ ਸੀਗਾ ਅਤੇ ਸ਼ਕਲ ਵੀ ਕੁਛ ਬਦਸਰੂਤ ਜਿਹੀ ਬਣ ਗਈ ਸੀਗੀ ਜਿਉਂ ਜਿਉਂ ਮੈਂ ਸੈਰ ਵੱਲ ਵੱਧਦਾ ਗਿਆ ਤਿਉਂ ਤਿਉਂ ਮੇਰੇ ਨਾਲ ਮੋਟਾਪਾ ਵੀ ਘੱਟਦਾ ਗਿਆ ਜੋ ਸਾਹ ਫੁੱਲਦਾ ਸੀ ਉਹ ਵੀ ਬੰਦ ਹੋ ਗਿਆ ਅਤੇ ਮੈਂ ਅਰਾਮ ਦੇ ਨਾਲ ਹੁਣ ਆਪਣਾ ਭੋਜਨ ਵੀ ਠੀਕ ਪਚਾ ਸਕਦਾ ਹਾਂ ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਵੀ ਜੋ ਸ਼ੁਰੂ ਹੋਣ ਲੱਗੀ ਸੀ ਉਹ ਸੈਰ ਕਰਨ ਦੇ ਨਾਲ ਉਹ ਵੀ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਹੈ ਔਰ ਇਸ ਤੋਂ ਇਲਾਵਾ ਜੋ ਆਪਣੀਆਂ ਧਵਨੀਆਂ ਸੀਗੀਆਂ ਵੇਨਸ ਉਹਨਾਂ 'ਚੋਂ ਨੀਲਾ ਨੀਲਾ ਜਿਹਾ ਦਿਖਾਵਾ ਹੁੰਦਾ ਸੀਗਾ ਉਹ ਵੀ ਹੁਣ ਬਹੁਤ ਠੀਕ ਹੈਗਾ ਹੈ ਇਸ ਪ੍ਰਕਾਰ ਸੈਰ ਕਰਨ ਦੇ ਨਾਲ ਮੈਨੂੰ ਬਹੁਤ ਹੀ ਪੌਜ਼ਟਿਵ ਪ੍ਰਭਾਵ ਪਿਆ